ਅੱਜ ਦੇ ਸਮੇਂ ਦੇ ਵਿੱਚ ਬੈਂਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੈਂਕਾਂ ਦੇ ਵਿੱਚ ਅਸੀਂ ਆਪਣੀ ਕੀਮਤੀ ਚੀਜ਼ਾਂ ਜਿਵੇਂ ਕਿ ਸੋਨੇ ਸੋਨੇ ਦੇ ਗਹਿਣੇ ਅਤੇ ਆਪਣਾ ਜੋ ਪੈਸੇ ਉਹ ਘਰ ਵਿੱਚ ਨਹੀਂ ਰੱਖ ਸਕਦੇ ਇਸ ਲਈ ਅਸੀਂ ਜ਼ਿਆਦਾ ਤੋਂ ਜ਼ਿਆਦਾ ਬੈਂਕ ਦੀ ਸਹਾਇਤਾ ਲੈਂਦੇ ਹਾਂ ਤਾਂ ਜੋ ਕਿ ਜੋ ਸਾਡਾ ਪੈਸਾ ਹੈ ਉਹ ਸਹੀ ਅਤੇ ਸੁਰੱਖਿਅਤ ਹੱਥਾਂ ਦੇ ਵਿੱਚ ਹੋਵੇ ਅਤੇ ਉਸਦੇ ਵਿੱਚ ਅਸੀਂ ਇਹ ਚੀਜ਼ਾਂ ਦੇ ਚੀਜ਼ਾਂ ਨੂੰ ਰੱਖਦੇ ਹਾਂ ਤਾਂ ਸਾਨੂੰ ਕਾਫੀ ਚੀਜ਼ਾਂ ਦੀ ਮੁਸ਼ਕਲ ਆਉਂਦੀ ਹੈ ਜਿੱਦਾਂ ਕਿ ਅਸੀਂ ਬੈਂਕ ਦੇ ਵਿੱਚ ਜਾਂਦੇ ਹਾਂ ਤਾਂ ਉੱਥੋਂ ਦਾ ਜੋ ਸਟਾਫ ਆ ਉਹ ਸਹੀ ਬਿਹੇਵ ਨਹੀਂ ਕਰਦਾ ਤਾਂ ਸਾਨੂੰ ਇੱਦਾਂ ਹੁੰਦਾ ਕਿ ਜੋ ਸਹੀ ਸਲੂਕ ਨਹੀਂ ਕਰਦਾ ਤਾਂ ਉਹਨਾਂ ਨੂੰ ਇੱਕ ਇੱਕ ਉਹਨਾਂ ਦੇ ਉਹ ਰੱਖਣੇ ਚਾਹੀਦੇ ਨੇ ਕਿ ਰੂਲ ਰੱਖਣੇ ਚਾਹੀਦੇ ਨੇ ਕਿ ਕਸਟਮਰ ਨੂੰ ਵੱਧ ਤੋਂ ਵੱਧ ਵੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਅਟੈਂਡ ਕੀਤਾ ਜਾਵੇ ਤਾਂ ਜੋ ਕਿ ਤਾਂ ਜੋ ਕਿ ਹਰ ਗਾ ਹਰ ਗਾਹਕ ਆਪਣਾ ਜੋ ਪੈਸਾ ਹੈ ਹਰ ਬੰਦਾ ਆਪਣਾ ਪੈਸਾ ਬੈਂਕ 'ਚ ਆਸਾਨੀ ਨਾਲ ਜਮ੍ਹਾਂ ਕਰਵਾ ਸਕੇ ਅਤੇ ਕਢਵਾ ਸਕੇ ਜ਼ਿਆਦਾਤਰ ਲੋਕਾਂ ਨੂੰ ਇਸ ਕਢੋ ਪੈਸੇ ਜਮ੍ਹਾਂ ਕਰਵਾਉਣ ਨਾਲੋਂ ਪੈਸੇ ਕਢਵਾਉਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਕਿ ਜਦੋਂ ਬੈਂਕ ਦਾ ਸਟਾਫ ਉਹਨਾਂ ਨਾਲ ਕਹਿ ਦਿੰਦਾ ਕਿ ਅੱਜ ਪੈਸੇ ਨਹੀਂ ਨਿਕਲਣਗੇ ਜਾਂ ਕਹਿ ਦੇਣਗੇ ਮਸ਼ੀਨ ਨਹੀਂ ਚੱਲ ਰਹੀ ਝੂਠ ਬੋਲਦੇ ਜਾਂ ਕਹਿ ਦੇਣਗੇ ਬਹੁਤ ਸਮਾਂ ਲੱਗੇਗਾ ਤਾਂ ਉਹਨਾਂ ਨੂੰ ਲਾਈਨਾਂ ਦੇ ਵਿੱਚ ਖੜ੍ਹਾ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਬਾਕੀ ਕੰਮ ਵੀ ਰੁਕ ਜਾਂਦੇ ਹਨ ਆਮ ਬੰਦੇ ਦੇ ਬਾਕੀ ਕੰਮ ਵੀ ਉਹ ਬਾਕੀ ਕੰਮ ਛੱਡ ਕੇ ਬੈਂਕ ਦੇ ਵਿੱਚ ਪੈਸੇ ਕਢਵਾਉਣ ਆਉਂਦਾ ਜਦੋਂ ਅਕਸਰ ਉਹਨਾਂ ਨੂੰ ਜ਼ਰੂਰਤ ਹੁੰਦੀ ਅਤੇ ਜ਼ਰੂਰਤ ਦੇ ਦੌਰਾਨ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਉਹਨਾਂ ਨੂੰ ਖੁਦ ਦੇ ਪੈਸੇ ਤਾਂ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਇਸਦੇ ਕਈ ਵਾਰ ਕਹਿ ਦਿੰਦੇ ਕਿ ਬੈਂਕ ਦੀ ਸਾਈਟ ਨਹੀਂ ਚੱਲ ਰਹੀ ਬੈਂਕ ਦੀ ਸਾਈਟ ਪਿੱਛੋਂ ਬੰਦ ਹੈ ਜਾਂ ਹਾਲੇ ਨਹੀਂ ਚੱਲੇਗੀ ਹੌਲੀ ਚੱਲ ਰਹੀ ਹੈ ਇੰਟਰਨੈਟ ਦਿੱਕਤ ਹੈ ਤਾਂ ਇਹਨਾਂ ਸੇਵਾਵਾਂ ਨੂੰ ਜਲਦ ਤੋਂ ਜਲਦ ਠੀਕ ਕੀਤਾ ਜ ਕਰਕੇ ਤਾਂ ਵੀ ਆਮ ਜੋ ਵਿਅਕਤੀ ਹੈ ਜੋ ਉਸ ਕਸਟਮਰ ਜਾਂ ਗਾਹਕ ਜਾਂਦਾ ਹੈ ਉਸਨੂੰ ਕੋਈ ਇੱਦਾਂ ਦੀ ਦਿੱਕਤ ਨਾ ਤਾਂ ਜੋ ਕਿ ਆਪਣਾ ਪੈਸਾ ਕਢਵਾ ਸਕੇ ਜਲਦ ਤੋਂ ਜਲਦ ਜਾਂ ਬਾਕੀ ਹੋਰ ਕੋਈ ਲੋਨ ਲੈਣ 'ਚ ਦਿੱਕਤ ਆਉਂਦੀ ਉਹਨਾਂ ਨੂੰ ਲੋਨ ਦੀ ਕਾਰਵਾਈ ਲਈ ਬਹੁਤ ਸਾਰੀ ਬਹੁਤ ਸਾਰੀ ਕਾਰਵਾਈਆਂ ਕਰਦੇ ਨੇ ਅਤੇ ਉਹਨਾਂ ਨੂੰ ਕੌਲ ਅਟੈਂਡ ਕਰਨੀਆਂ ਪੈਂਦੀਆਂ ਨੇ ਅਤੇ ਜਿਸ ਦੇ ਦੌਰਾਨ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਅਤੇ ਸੋ ਇਹਨਾਂ ਸੇਵਾਵਾਂ ਨੂੰ ਸੇਵਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਸਾਰ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਤਾਂ ਜੋ ਕਿ ਬੈਂਕ ਦੇ ਵਿੱਚ ਦੇਖਣ ਵਿੱਚ ਸੁਧਾਰ ਆਵੇ ਅਤੇ ਗਾਹਕਾਂ ਨੂੰ ਕੋਈ ਵੀ ਕੋਈ ਵੀ ਪਰੇਸ਼ਾਨੀ ਨਾ ਆਵੇ ਤਾਂ ਹਰ ਸਕੀਮ ਜੋ ਬੈਂਕ ਦੇ ਵਿੱਚ ਹਰ ਸਕੀਮ ਆਉਂਦੀ ਤਾਂ ਉਸਦਾ ਜੋ ਲਾਭ ਚੰਗੀ ਤਰ੍ਹਾਂ ਲੈ ਸਕਣ ਜੋ ਬੈਂਕ ਦੇ ਵਿੱਚ ਕਈ ਵਾਰ ਸਕੀਮ ਆਉਂਦੀ ਲੋਨ ਸਕੀਮ ਤਾਂ ਬੈਂਕ ਦੇ ਜੋ ਸਟਾਫ ਹੁੰਦਾ ਉਹ ਨਹੀਂ ਦੱਸਦਾ ਤਾਂ ਉਹਨਾਂ ਨੂੰ ਇਸ ਬਾਰੇ ਜੋ ਸਕੀਮ ਨਵੀਂ ਸਰਕਾਰ ਵੱਲੋਂ ਆਉਂਦੀ ਤਾਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਕਿ ਆਮ ਬੰਦਾ ਉਸ ਦੇ ਉਸ ਸਕੀਮ ਦਾ ਲਾਭ ਲੈ ਸਕੇ ਅਤੇ ਆਪਣੇ ਜੀਵਨ ਦੇ ਸੁਧਾਰ ਕਰ ਸਕੇ ਧੰਨਵਾਦ